ਪੰਜਾਬ ਵਿੱਚ ਕਣਕ ਦੀ ਰੋਟੀ ਮੁੱਖ ਪਕਵਾਨ ਹੈ ਇਸ ਤੋਂ ਇਲਾਵਾ ਸਰਦੀਆਂ ਦੀ ਰੁੱਤ ਦੇ ਵਿੱਚ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਬਹੁਤ ਪ੍ਰਸਿੱਧ ਪਕਵਾਨ ਮੰਨਿਆ ਜਾਂਦਾ ਹੈ ਇਸ ਪਕਵਾਨ ਨੂੰ ਲੋਕ ਇਸ ਕਰਕੇ ਵੀ ਪਸੰਦ ਕਰਦੇ ਹਨ ਕਿਉਂਕਿ ਇਹ ਸੌਖਾ ਬਣ ਜਾਂਦਾ ਹੈ ਔਰ ਇਸਦੀ ਬਹੁਤੀ ਕੀਮਤ ਵੀ ਉਹਨਾਂ ਨੂੰ ਅਦਾ ਨਹੀਂ ਕਰਨੀ ਪੈਂਦੀ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਦੁੱਧ ਦਹੀਂ ਲੱਸੀ ਇਹਨਾਂ ਨੂੰ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ ਅਤੇ ਦੁੱਧ ਤੋਂ ਬਣੇ ਹੋਏ ਕਈ ਪ੍ਰੋਡਕਟ ਜੋ ਪਦਾਰਥ ਨੇ ਉਹ ਵੀ ਲੋਕ ਬਹੁਤ ਛਕਦੇ ਹਨ ਅਤੇ ਇਸ ਤੋਂ ਬਿਨਾਂ ਜੇ ਕਹੀਏ ਫਾਸਟ ਫੂਡ ਦੀ ਜੇ ਗੱਲ ਕਰੀਏ ਜਿਹੜੇ ਪੰਜਾਬ ਦੇ ਹਨ ਕੁਦਰਤੀ ਉਹਨਾਂ ਵਿੱਚ ਅ ਕੁਲਚੇ ਛੋਲੇ ਹਨ ਅਤੇ ਕੁਲਚੇ ਅੰਮ੍ਰਿਤਸਰ ਦੇ ਬਹੁਤ ਮਸ਼ਹੂਰ ਗਿਣੇ ਜਾਂਦੇ ਹਨ ਔਰ ਇਹ ਇੱਕ ਤੰਦੂਰੀ ਭੋਜਨ ਹੈ ਤੰਦੂਰ ਦੀ ਪੰਜਾਬ ਦੇ ਪਕਵਾਨਾਂ ਵਿੱਚ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਅਤੇ ਤੰਦੂਰ ਦੀ ਵਰਤੋਂ ਵਾਲੇ ਜਿਹੜੇ ਭੋਜਨ ਹਨ ਉਹਨਾਂ ਵਿੱਚ ਤੰਦੂਰੀ ਰੋਟੀ ਰੁਮਾਲੀ ਰੋਟੀ ਅਤੇ ਹੋਰ ਜੋ ਟਿੱਕੇ ਤੰਦੂਰੀ ਟਿੱਕੇ ਵੀ ਬਣਦੇ ਹਨ ਇਹਨਾਂ ਨੂੰ ਲੋਕ ਬਹੁਤ ਖਾਣਾ ਪਸੰਦ ਕਰਦੇ ਹਨ